ਮੈਨੂੰ ਪੁਰਾਣੇ ਸਮੇਂ ਤੋਂ ਹੀ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਹੈ ਜਦੋਂ ਮੈਂ ਆਪਣੇ ਸਕੂਲ ਦੇ ਵਿੱਚ ਤੀਜੀ ਜਮਾਤ ਵਿੱਚ ਪੜ੍ਹਦਾ ਸੀ ਤਾਂ ਮੈਂ ਆਪਣੀ ਜਮਾਤ ਦੇ ਵਿਦਿਆਰਥੀਆਂ ਨਾਲ ਇੱਕ ਜਗ੍ਹਾ ਘੁੰਮਣ ਗਿਆ ਸੀ ਜੋ ਕਿ ਹਰੀਕੇ ਪੱਤਣ ਹੈ ਉਹ ਦ੍ਰਿਸ਼ ਬਹੁਤ ਹੀ ਨਜ਼ਾਰੇਦਾਇਕ ਸੀ ਬਹੁਤ ਵਧੀਆ ਦ੍ਰਿਸ਼ ਸੀ ਅਸੀਂ ਉੱਥੇ ਆਪਣਾ ਪਹਿਲੀ ਵਾਰੀ ਮੈਂ ਆਪਣਾ ਕੈਮਰਾ ਲੈ ਕੇ ਗਿਆ ਸੀ ਉੱਥੇ ਮੈਂ ਵੱਖਰੇ ਵੱਖਰੇ ਪੰਛੀ ਅਤੇ ਜਾਨਵਰਾਂ ਦੀਆਂ ਫੋਟੋਆਂ ਕਲਿੱਕ ਕੀਤੀਆਂ ਜੋ ਕਿ ਮੇਰੇ ਤੋਂ ਅੱਜ ਵੀ ਸਾਂਭੀਆਂ ਹੋਈਆਂ ਹਨ ਅਤੇ ਕੁਛ ਸਮਾਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਰੀਲਾਂ ਵਾਲੇ ਕੈਮਰੇ ਚੱਲਦੇ ਸੀ ਅਤੇ ਅੱਜ ਕੱਲ੍ਹ ਡਿਜ਼ੀਟਲ ਕੈਮਰੇ ਚੱਲਦੇ ਹਨ ਮੇਰੀਆਂ ਤਸਵੀਰਾਂ ਮੇਰੇ ਦਾਦਾ ਦਾਦੀ ਜੀ ਦੇ ਨਾਲ ਹਨ ਜੋ ਕਿ ਘੱਟੋ ਘੱਟ ਤੇਈ ਚੌਵੀ ਸਾਲ ਪੁਰਾਣੀਆਂ ਹਨ ਉਹ ਤਸਵੀਰਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਅਤੇ ਉਹ ਮੈਮਰੀਜ਼ ਦੁਬਾਰਾ ਕਦੇ ਵੀ ਵਾਪਸ ਨਹੀਂ ਆ ਸਕਦੀਆਂ ਸੋ ਮੈਂ ਇਹ ਕਹਿੰਦਾ ਹਾਂ ਕਿ ਪੁਰਾਣੀਆਂ ਫੋਟੋਸ ਅਤੇ ਆਪਣੀਆਂ ਫੋਟੋਆਂ ਬਹੁਤ ਜ਼ਿਆਦਾ ਇੰਪੋਰਟੈਂਟ ਸਨ ਸਾਡੀ ਲਾਈਫ ਦੇ ਵਿੱਚ ਅੱਜ ਕੱਲ੍ਹ ਦੀ ਫੋਟੋਸ ਦਾ ਇਹ ਫਾਇਦਾ ਹੈ ਡਿਜ਼ੀਟਲ ਜਿਹੜੀਆਂ ਫੋਟੋਆਂ ਚੱਲਦੀਆਂ ਹਨ ਉਹਦਾ ਇਹ ਫਾਇਦਾ ਹੈ ਕਿ ਉਸਨੂੰ ਆਪਾਂ ਲੰਬੇ ਸਮੇਂ ਤੱਕ ਸੇਵ ਕਰਕੇ ਰੱਖ ਸਕਦੇ ਹਾਂ ਅਤੇ ਜਦੋਂ ਜੀ ਕਰੇ ਸਿਰਫ ਕੁਛ ਹੀ ਸੈਕਿੰਟਿਆਂ ਦੇ ਵਿੱਚ ਕੁਛ ਹੀ ਸੈਕਿੰਟਸ ਦੇ ਵਿੱਚ ਉਹਨਾਂ ਦਾ ਪ੍ਰਿੰਟ ਆਊਟ ਲੈ ਸਕਦੇ ਹਾਂ ਪੁਰਾਣੇ ਸਮੇਂ ਵਿੱਚ ਇੱਕ ਫੋਟੋ ਕਲਿੱਕ ਕਰਨ ਤੋਂ ਬਾਅਦ ਚਾਰ ਤੋਂ ਪੰਜ ਦਿਨ ਦਾ ਸਮਾਂ ਲੱਗਦਾ ਸੀ ਫੋਟੋ ਨੂੰ ਨਿਕਾਲਣ ਦੇ ਵਿੱਚ ਅੱਜ ਉਹ ਕੰਮ ਸੈਕਿੰਡਸ ਦੇ ਵਿੱਚ ਹੋ ਜਾਂਦਾ ਹੈ ਸੋ ਟੈਕਨੋਲੌਜੀ ਦੇ ਆਉਣ ਦੇ ਨਾਲ ਚੀਜ਼ਾਂ ਬਦਲ ਰਹੀਆਂ ਹਨ ਪਰ ਜੋ ਮੈਮਰੀਜ਼ ਪੁਰਾਣੇ ਕੈਮਰੇ ਜਾਂ ਪੁਰਾਣੀਆਂ ਯਾਦਾਂ ਹਨ ਉਹ ਕਦੀ ਵੀ ਰਿਪੀਟ ਨਹੀਂ ਹੋ ਸਕਦੀਆਂ ਸੋ ਪੁਰਾਣੀਆਂ ਮੈਮਰੀਜ਼ ਅਤੇ ਫੋਟੋਸ ਬਹੁਤ ਜਾ ਜ਼ਿਆਦਾ ਇੰਪੋਰਟੈਂਸ ਪਲੇਅ ਕਰਦੀਆਂ ਸਨ ਸਾਰਿਆਂ ਦੀ ਲਾਈਫ ਦੇ ਵਿੱਚ